ਸਾਡੇ ਇਲਾਕੇ ਵਿੱਚ ਬਹੁਤ ਸਾਰੇ ਧਾਰਮਿਕ ਤਿਉਹਾਰ ਦੀਵਾਲੀ ਬਸੰਤ ਰੁੱਤ ਵਿਸਾਖੀ ਦਾ ਮੇਲਾ ਸਾਵਣ ਮੇਲਾ ਇਹਨਾਂ ਸਾਰੇ ਤਿਉਹਾਰਾਂ ਨੂੰ ਬੜੇ ਹੀ ਚਾਓ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਦੀਵਾਲੀ ਜਦੋਂ ਵੀ ਆਉਂਦੀ ਹੈ ਤਾਂ ਘਰਾਂ ਵਿੱਚ ਰੰਗ ਰੋਗਨ ਸਾਫ ਸਫਾਈ ਕੀਤੀ ਜਾਂਦੀ ਹੈ ਨਵੇਂ ਕੱਪੜੇ ਪਾਏ ਜਾਂਦੇ ਹਨ ਮਠਿਆਈਆਂ ਖਰੀਦੀਆਂ ਜਾਂਦੀਆਂ ਹਨ ਰਾਤ ਨੂੰ ਲਛਮੀ ਜੀ ਦੀ ਆਰਤੀ ਕਰਕੇ ਪਟਾਕੇ ਜਲਾਏ ਜਾਂਦੇ ਹਨ ਇਸ ਤਰ੍ਹਾਂ ਦੀਵਾਲੀ ਮਨਾਈ ਜਾਂਦੀ ਹੈ ਸਾਵਣ ਨੂੰ ਵੀ ਬੜੇ ਚਾਓ ਨਾਲ ਮਨਾਇਆ ਜਾਂਦਾ ਹੈ ਸਾਵਣ ਹਮੇਸ਼ਾ ਧੀਆਂ ਦਾ ਦਿਨ ਹੁੰਦਾ ਹੈ ਇਹ ਮੇਲਾ ਪਿੰਡ ਦੇ ਪੈਲੀਆਂ ਵਿੱਚ ਹੀ ਲੱਗਦਾ ਹੈ ਉਸ ਦਿਨ ਧੀਆਂ ਗਿੱਧੇ ਪਾਉਂਦੀਆਂ ਹਨ ਕਿੱਕਲੀਕ ਲਾਉਂਦੀਆਂ ਹਨ ਅਤੇ ਆਪਣੀ ਖੁਸ਼ੀ ਜ਼ਾਹਿਰ ਕਰਦੀਆਂ ਹਨ ਵਿਸਾਖੀ ਦੇ ਮੇਲੇ ਵਾਲੇ ਦਿਨ ਵੀ ਖੇਤਾਂ ਵਿੱਚ ਮੇਲਾ ਲੱਗਦਾ ਹੈ ਜਿਸ ਦਿਨ ਕਿਸਾਨ ਆਪਣੀ ਨਵੀਂ ਫਸਲ ਨੂੰ ਕੱਟਣ ਦੀ ਖੁਸ਼ੀ ਮਨਾਉਂਦੇ ਹਨ ਬਸੰਤ ਰੁੱਤ ਨੂੰ ਵੀ ਬੜੇ ਚਾਉ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਪੀਲੇ ਕੱਪੜੇ ਬੜੇ ਚਾਉ ਨਾਲ ਪਾਉਂਦੇ ਹਨ